ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਬੇਰੁਜ਼ਗਾਰੀ ਦਿਨੋਂ ਦਿਨ ਵੱਧ ਰਹੀ ਹੈ ਗਰੀਬੀ ਤਾਂ ਆਉਣੀ ਹੈ ਜਦੋਂ ਰ ਬੇਰੁਜ਼ਗਾਰੀ ਹੈਗੀ ਆ ਹੈ ਨਾ ਅਤੇ ਪੰਜਾਬ ਦੀ ਸਰਕਾਰ ਇਹਦੇ ਲਈ ਪਹਿਲਾਂ ਤਾਂ ਕੁਛ ਵੀ ਨਹੀਂ ਕਰ ਰਹੀ ਕੋਈ ਵੀ ਕੰਮ ਨਹੀਂ ਕਰ ਰਹੀ ਕੋਈ ਵੀ ਕਿਸੇ ਬੱਚੇ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਸ ਨਾਲ ਕੀ ਹੋ ਰਿਹਾ ਹੈ ਪੰਜਾਬ ਵਿੱਚ ਜਿਹੜੇ ਕ੍ਰਾਈਮ ਰੇਟ ਆ ਉਹ ਦਿਨੋਂ ਦਿਨ ਵੱਧ ਰਹੇ ਕਿਉਂਕਿ ਨੌਜਵਾਨ ਆ ਘਰ ਬੈਠੇ ਆ ਨਸ਼ਾ ਪੱਤਾ ਕਰ ਰਹੇ ਨਸ਼ੇ ਲਈ ਪੈਸੇ ਲਈ ਉਹ ਲੁੱਟਾਂ ਖੁੱਟੀਆਂ ਕਰ ਰਹੇ ਹੈ ਚੋਰੀਆਂ ਕਰ ਰਹੇ ਹੈ ਕਿਸੇ ਨੂੰ ਮਾਰ ਰਹੇ ਹੈ ਇਹ ਰੀਜ਼ਨ ਹੈ ਵੀ ਪੰਜਾਬ ਵਿੱਚ ਦਿਨੋਂ ਦਿਨ ਕ੍ਰਾਈਮ ਰੇਟ ਆ ਜਿਹੜੀ ਅਪ ਹੋ ਰਹੀ ਹੈ ਅਤੇ ਬੇਰੁਜ਼ਗਾਰੀ ਹੈ ਨਹੀਂ ਕਿਉਂਕਿ ਸਰਕਾਰਾਂ ਜੋ ਸਾਡੀਆਂ ਹੈਗੀਆਂ ਬਹੁਤ ਮਾੜੀਆਂ ਨੇ ਕੋਈ ਵੀ ਕੰਮ ਨਹੀਂ ਕਰਦੀਆਂ ਕੋਈ ਵੀ ਉਹਨਾਂ ਕੋਲ ਸਥਾਨ ਉਹ ਨਹੀਂ ਹੈਗਾ ਦੂਜੀ ਗੱਲ ਪੰਜਾਬ ਦੇ ਲੋਕਾਂ ਦੀ ਜਿਹੜੀ ਬੇਰੁਜ਼ਗਾਰੀ ਵੱਧ ਰਹੀ ਹੈ ਅਤੇ ਲੋਕ ਦਿਨੋਂ ਦਿਨ ਫੋਰਨ ਕੰਟਰੀਆਂ ਵਿੱਚ ਜਾ ਰਹੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਜਿਹੜਾ ਸਾਡਾ ਪੰਜਾਬ ਆ ਅੱਧ ਤੋਂ ਵੱਧ ਪੰਜਾਬ ਹੈ ਜਿਹੜਾ ਬਾਹਰ ਚਲਾ ਗਿਆ ਕੈਨੇਡਾ ਵਗੈਰਾ ਦੇਸ਼ਾਂ ਵਿੱਚ ਜਾ ਰਿਹਾ ਕਿਉਂਕਿ ਉੱਥੇ ਉਹਨਾਂ ਨੂੰ ਕੰਮ ਮਿਲ ਰਿਹਾ ਅਤੇ ਇੱਥੇ ਉਹ ਫ੍ਰੀ ਬੈਠੇ ਆ ਉਹਨਾਂ ਨੂੰ ਕੋਲ ਕੰਮ ਨਹੀਂ ਉਹ ਪਲੱਸ ਟੂ ਤੋਂ ਬਾਅਦ ਜਿਹੜੇ ਬੱਚੇ ਆਈਲੈਟਸ ਕਰਕੇ ਬਾਹਰ ਜਾ ਰਹੇ ਦਿਨੋਂ ਦਿਨ ਪੰਜਾਬ ਹੈ ਜਿਹੜਾ ਖਾਲੀ ਹੁੰਦਾ ਜਾ ਰਿਹਾ ਹੈਗਾ ਇਹਦੇ ਲਈ ਸਿਰਫ ਸਾਡੀਆਂ ਸਰਕਾਰਾਂ ਹੀ ਜ਼ਿੰਮੇਵਾਰੀਆਂ ਕਿਉਂਕਿ ਉਹ ਕੋਈ ਵੀ ਕੰਮ ਜਿਹੜਾ ਸਹੀ ਢੰਗ ਨਾਲ ਨਹੀਂ ਕਰ ਰਹੀਆਂ ਓਕੇ ਜੀ ਧੰਨਵਾਦ ਠੀਕ ਹੈ